ਕੱਲ੍ਹ ਨਾ ਮੇਰੇ ਬੇਟੇ ਨੇ ਐਮਾਜ਼ੋਨ ਤੋਂ ਨਾ ਇੱਕ ਸਪੀਕਰ ਨਾ ਸਪੀਕਰ ਨਾਲ ਉਹਦੇ ਮਾਈਕ ਹੈ ਨਾ ਕਾਫੀ ਟਾਈਮ ਤੋਂ ਮੇਰੇ ਪਿੱਛੇ ਪਿਆ ਹੋਇਆ ਸੀ ਕਿ ਮੰਮਾ ਮੈਂ ਓਨਲਾਈਨ ਓਡਰ ਕਰਨਾ ਮੰਮਾ ਮੈਂ ਔਨਲਾਈਨ ਅਤੇ ਅਸੀਂ ਸਾਈਟ ਦੇਖ ਰਹੇ ਸੀ ਕਿਹੜੀ ਅਤੇ ਫਿਰ ਉਹਨੇ ਜਿਹੜੀ ਚੂਜ਼ ਕੀਤੀ ਉਹ ਐਮਾਜ਼ੋਨ ਕੀਤੀ ਐਮਾਜ਼ੋਨ ਤੋਂ ਨਾ ਉਹਨੇ ਆਪਣਾ ਜਿਹੜਾ ਸਪੀਕਰ ਸੀ ਪਲੱਸ ਹੈ ਨਾ ਨਾਲ ਮਾਈਕ ਸੀ ਮੰਗਵਾਇਆ ਅਤੇ ਪਹਿਲਾਂ ਤਾਂ ਮੈਨੂੰ ਡਾਊਟ ਸੀ ਕਿ ਔਨਲਾਈਨ ਪਤਾ ਨਹੀਂ ਸਮਾਨ ਹੈ ਨਾ ਕਿਵੇਂ ਦਾ ਏ ਕਿ ਅਸੀਂ ਇੰਨਾਂ ਪੈਸਾ ਵੀ ਲਗਾ ਰਹੇ ਹਾਂ ਕੋਸਟਲੀ ਹੈ ਬਟ ਜਦੋਂ ਉਹਨੂੰ ਆਪਾਂ ਯੂਜ਼ ਕੀਤਾ ਹੈ ਨਾ ਓਪਨ ਕੀਤਾ ਔਰ ਬੇਟੇ ਨੇ ਸਾਰਾ ਫਿੱਟ ਕੀਤਾ ਉਸ ਤੋਂ ਬਾਅਦ ਇੰਨਾਂ ਵਧੀਆ ਉਹਦਾ ਨਾ ਮਤਲਬ ਕਿ ਇੰਨਾਂ ਲਾਊਡਲੀ ਜਦੋਂ ਉਹਦੇ ਵਿੱਚ ਬੋਲਦਾ ਸੀ ਕੁਛ ਵੀ ਇੰਨਾਂ ਕਲੀਅਰ ਕਿ ਇੱਦਾਂ ਲੱਗਦਾ ਸੀ ਜਿਵੇਂ ਇੱਕ ਅਨਾਊਂਸਮੈਂਟ ਗੁਰਦੁਆਰਾ ਸਾਹਿਬ ਹੁੰਦੀ ਹੈ ਨਾ ਮਾਈਕ ਵਿੱਚ ਸੇਮ ਉਹ ਉਵੇਂ ਹੀ ਬੋਲ ਰਿਹਾ ਸੀਗਾ ਘਰ ਉੱਪਰ ਅਤੇ ਸਾਨੂੰ ਇਹੀ ਲੱਗ ਰਿਹਾ ਸੀਗਾ ਕਿ ਉਹ ਗੁਰਦੁਆਰਾ ਸਾਹਿਬ ਵਾਲੇ ਮਾਈਕ ਤੋਂ ਹੀ ਅਨਾਊਂਸਮੈਂਟ ਹੋ ਰਹੀ ਆ ਮਤਲਬ ਕਿ ਇੰਨਾਂ ਕਲੀਅਰ ਇੰਨਾਂ ਵਧੀਆ ਸੀਗਾ ਅਤੇ ਮੈਂ ਤਾਂ ਮਤਲਬ ਬਹੁਤ ਵਧੀਆ ਇਹਦਾ ਪਰੇਸ ਕਰੂੰਗੀ ਐਮਾਜ਼ੋਨ ਵਾਲੀ ਕੰਪਨੀ ਨੂੰ ਕਿ ਇਨ੍ਹਾਂ ਨੇ ਬਹੁਤ ਵਧੀਆ ਜਿਹੜਾ ਪ੍ਰੋਡਕਟ ਹੈ ਭੇਜਿਆ ਏ ਅਤੇ ਨੈਕਟਸ ਟਾਈਮ ਤੋਂ ਵੀ ਅਗਰ ਬੇਟੇ ਨੇ ਕਿਹਾ ਕਿ ਮੰਮਾ ਆਪਾਂ ਕੋਈ ਹੋਰ ਚੀਜ਼ ਆਪਣੀ ਓਡਰ ਕਰਦੇ ਹਾਂ ਔਨਲਾਈਨ ਤਾਂ ਜਿਹੜਾ ਮੇਰਾ ਆਨਸਰ ਹੋਏਗਾ ਉਹ ਪੋਜ਼ੀਟਿਵ ਹੀ ਹੋਏਗਾ ਕਿਉਂਕਿ ਇਹ ਤੋਂ ਹੀ ਮੈਨੂੰ ਪਤਾ ਲੱਗ ਗਿਆ ਕਿ ਇਹ ਜਿਹੜੀ ਕੰਪਨੀ ਹੈ ਬਹੁਤ ਵਧੀਆ ਪ੍ਰੋਡਕਟ ਆ ਜਿਹੜੇ ਉਹ ਸੇਲ ਕਰ ਰਹੀ ਆ